ਹੈਲੋ ਹਾਂ ਸਤਿ ਸ਼੍ਰੀ ਅਕਾਲ ਬੇਟਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਨਾਂ ਦੇ ਹੀ ਬੋਲਦੇ ਹਾਂ ਅਸੀਂ ਅੱਛਾ ਜੀ ਅੱਛਾ ਜੀ ਕਿਹੜਾ ਪਿੰਡ ਹੈ ਤੁਹਾਡਾ ਅੱਛਾ

ਹਾਂ ਸੋਨਾ ਤਾਂ ਅੱਸੀ ਨੂੰ ਹੈ ਅੱਸੀ ਤੱਕ ਪਹੁੰਚਿਆ ਪਿਆ ਹਾਂਜੀ ਅੱਛਾ ਜਿਵੇਂ ਟਿੱਕਾ ਝੁੰਮਰ ਸੂਈ ਇਸ ਤਰਾਂ ਨਹੀਂ ਉਹ ਸਾਡੇ ਕੋਲ ਬਣੇ ਬਣਾਏ ਵੀ ਹੁੰਦੇ ਆ ਅਤੇ ਜੇ ਤੁਸੀਂ ਵੀ ਆਰਡਰ 'ਤੇ ਬਣਵਾਉਣੇ ਤਾਂ ਅਸੀਂ ਉਹ ਵੀ ਬਣਾ ਦਵਾਂਗੇ ਹਾਂ ਹਾਂ ਹਾਂ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਸਾਰਾ ਕੁਛ ਬਣਿਆ ਬਣਿਆ ਵੀ ਮਿਲ ਜਾਂਦਾ ਜੇ ਤੁਸੀਂ ਆਰਡਰ 'ਤੇ ਬਣਵਾਉਣਾ ਤਾਂ ਆਰਡਰ 'ਤੇ ਵੀ ਬਣ ਜਾਊਗਾ ਅੰਗੂਰਾਂ ਦੀ ਵੇਲ ਵਾਲੇ ਅੱਛਾ ਉਹ ਵੀ ਬਣਾ ਦਵਾਂਗੇ ਤੁਹਾਨੂੰ ਦੱਸ ਦਿਓ ਹੈਨਾ ਵੀ ਡਿਜ਼ਾਇਨ ਦਿਖਾ ਦਿਓ ਸਾਨੂੰ ਹਾਂ ਠੀਕ ਹੈ ਠੀਕ ਹੈ ਤੁਸੀਂ ਸਾਨੂੰ ਵਿਖਾ ਦਿਓ ਅਸੀਂ ਸਾਰਾ ਕੁਛ ਬਣਾ ਦਵਾਂਗੇ ਹਾਂਜੀ ਹਾਂਜੀ ਹਾਂ ਇੱਕ ਮੁਰਕੀਆਂ ਮੁਰਕੀਆਂ ਨੱਥ ਟਿੱਕਾ ਹਾਂ ਹਾਂ ਹਾਂ ਮੋਹਰਾਂ ਹੁੰਦੀ ਗਲ੍ਹ 'ਚ ਹੁਣ ਸੈਟ ਬਣਾਉਣ ਦੇ ਪਹਿਲਾਂ ਹਾਂ ਹਾਂਜੀ ਹਾਂਜੀ ਹਾਂਜੀ ਅਰਦਾ ਡਿਜਾਇਨ ਵੀ ਹੈਗੇ ਜੇ ਤੁਸੀਂ ਬਣਵਾਉਣੇ ਆ ਤਾਂ ਤੁਸੀਂ ਆ ਜਾਓ ਵੀ ਸਾਨੂੰ ਦੱਸ ਜਿਓ ਵੀ ਕਿਸ ਤਰ੍ਹਾਂ ਦੇ ਬਣਵਾਉਣੇ ਆ ਹਾਂਜੀ ਹਾਂ ਠੀਕ ਆ ਠੀਕ ਆ ਅਸੀਂ ਉਹ ਹੀ ਵੇਖ ਕੇ ਹੀ ਬਣਾ ਦਵਾਂਗੇ ਤੁਹਾਨੂੰ ਹਾਂਜੀ ਦੁਕਾਨ 'ਤੇ ਕੱਲ੍ਹ ਨੂੰ ਆਵਾਂਗੇ ਠੀਕ ਆ ਠੀਕ ਆ ਹਾਂ ਨਹੀਂ ਨਹੀਂ ਤੁਸੀਂ ਨਾਲ ਹੀ ਆ ਜਾਓ ਅਤੇ ਤੁਸੀਂ ਜਿਹੜਾ ਕੁਛ ਬਣਵਾਉਣਾ ਅਤੇ ਵੀ ਤੁਹਾਨੂੰ ਦੱਸ ਦਿਆ ਜੇ ਵੀ ਪਏ ਵੀ ਹੈ ਅਤੇ ਚੱਲ ਜੇ ਤੁਸੀਂ ਬਣਵਾਉਣੇ ਆ ਆਪਣੀ ਪਸੰਦ ਦੇ ਹੁੰਦਾ ਹੈ ਵੀ ਚੱਲ ਕੁੜੀਆਂ ਨੂੰ ਟਾਈਮ ਤਾਂ ਵੀ ਲੱਗਦਾ ਹੀ ਹੈ ਜੀ ਇੱਕ ਦੋ ਦਿਨ ਹਾਂ ਹਾਂ ਬਣ ਜਾਣਗੇ ਉਦੋਂ ਤੱਕ ਤਾਂ ਵਿਆਹ ਦੇ ਨੇੜੇ ਤੇੜੇ ਬਣ ਜਾਣਗੇ ਠੀਕ ਹੈ ਠੀਕ ਆ ਠੀਕ ਹੈ ਬੇਟਾ ਠੀਕ ਹੈ ਸਤਿ ਸ਼੍ਰੀ ਅਕਾਲ